ਪੇਂਡੂ ਪੱਧਰ 'ਤੇ ਖੇਡਾਂ ਖੇਡਣ ਨਾਲ ਬਹੁਤ ਸਾਰੇ ਫਾਇਦੇ ਹੁੰਦੇ ਹਨ ਜਿਸ ਵਿੱਚ ਭਾਈਚਾਰਕ ਨਿਰਮਾਣ ਸਿਹਤ ਲਾਭ ਹੁਨਰ ਵਿਕਾਸ ਤਣਾਅ ਤੋਂ ਮੁਕਤ ਮਨੋਰੰਜਨ ਸੱਭਿਆਚਾਰਿਕ ਸਮਾਲ ਹਨ ਬਹੁਤ ਸਾਰੀ ਖੇਡਾਂ ਵਿੱਚ ਸਰੀਰਕ ਗਤੀਵਿਧੀ ਸ਼ਾਮਿਲ ਹੁੰਦੀ ਹੈ ਜੋ ਬਿਹਤਰ ਸਿਹਤ ਤੰਦਰੁਸਤੀ ਦੇ ਪੱਧਰਾਂ ਵਿੱਚ ਯੋਗਦਾਨ ਪਾਉਂਦੇ ਹਨ ਬੰਦਿਆਂ ਵਿੱਚ ਹੁਨਰ ਵਿਕਾਸ ਹੋ ਜਾਂਦਾ ਹੈ ਆਪਸ 'ਚ ਖੇਡਾਂ ਖੇਡਣ ਨਾਲ ਇੱਕ ਦੂਜੇ ਨਾਲ ਤਾਲਮੇਲ ਕਰਨਾ ਸਿੱਖ ਜਾਂਦੇ ਹਨ ਟੀਮ ਵਰਕ ਦੀ ਭਾਵਨਾ ਵੀ ਪੈਦਾ ਹੋ ਜਾਂਦੀ ਹੈ ਇੱਕ ਦੂਜੇ ਨਾਲ ਚੰਗੀ ਤਰ੍ਹਾਂ ਗੱਲਬਾਤ ਕਰਨਾ ਸਿੱਖ ਜਾਂਦੇ ਹਨ ਪਿੰਡ ਪੱਧਰ 'ਤੇ ਖੇਡਾਂ ਖੇਡਣ ਨਾਲ ਲੋਕ ਇਕੱਠੇ ਹੁੰਦੇ ਹਨ ਅਤੇ ਭਾਈਚਾਰਾ ਦੀ ਭਾਵਨਾ ਪੈਦਾ ਕਰਦੇ ਹਨ ਮੁਸ਼ਕਿਲ ਆਉਣ 'ਤੇ ਇੱਕ ਦੂਜੇ ਦੀ ਮਦਦ ਕਰਦੇ ਹਨ ਪੇਂਡੂ ਪੱਧਰ 'ਤੇ ਖੇਡੀ ਜਾਣ ਵਾਲੀਆਂ ਰਵਾਇਤੀਆਂ ਖੇਡਾਂ ਸੱਭਿਆਚਾਰਕ ਵਿਰਾਸਤ ਅਤੇ ਪ੍ਰੰਪਰਾ ਨੂੰ ਸੁਰੱਖਿਅਤ ਰੱਖਣ ਵਿੱਚ ਮਦਦ ਕਰਦੀਆਂ ਹਨ ਇਹ ਖੇਡਾਂ ਅਕਸਰ ਪੀੜ੍ਹੀ ਦਰ ਪੀੜ੍ਹੀ ਚੱਲਦੀਆਂ ਰਹਿੰਦੀਆਂ ਹਨ ਅਤੇ ਇੱਕ ਭਾਈਚਾਰ ਦੀਆਂ ਕਹਾਣੀਆਂ ਅਤੇ ਰੀਤੀ ਰਿਵਾਜ਼ਾਂ ਨੂੰ ਜਿਉਂਦਾ ਰੱਖਦੀਆਂ ਹਨ